ਟੈਕਨਾਲੋਜੀ ਨੇ ਸਿੱਖਿਆ ਉਦਯੋਗ ਵਿੱਚ ਵਧੇਰੇ ਮਦਦ ਕੀਤੀ ਹੈ ਉਦਾਹਰਣ ਵਜੋਂ ਮਹਾਮਾਰੀ ਸਮੇਂ ਬੱਚਿਆਂ ਦੇ ਲਈ ਆਨਲਾਈਨ ਕਲਾਸਾਂ ਲਗਵਾਈਆਂ ਗਈਆਂ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਜਾਰੀ ਰਹਿਣ ਵਿੱਚ ਵਧੇਰੇ ਮਦਦ ਮਿਲੀ ਇਸ ਤੋਂ ਇਲਾਵਾ ਯੂਟੀਊਬ ਉੱਪਰ ਵੀ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਵੀਡੀਓਜ ਉਪਲਬਧ ਹਨ ਜਿਸ ਨਾਲ ਬੱਚਿਆਂ ਦੀ ਪੜਾਈ ਹੋਰ ਵਧੇਰੇ ਸੁਖਾਲੀ ਹੋ ਗਈ ਅਤੇ ਉਹਨਾਂ ਨੂੰ ਸਮਝਣ ਵਿੱਚ ਬਹੁਤ ਇਜੀ ਹੋ ਗਿਆ ਆਨਲਾਈਨ ਕੋਰਸ ਵੀ ਬਹੁਤ ਸਾਰੇ ਉਪਲਬਧ ਹਨ ਅਸੀਂ ਆਨਲਾਈਨ ਦਾਖਲਾ ਵੀ ਕਰਵਾ ਸਕਦੇ ਹਾਂ ਇਸ ਲਈ ਸਾਨੂੰ ਜਾਣ ਆਉਣ ਦੀ ਦਿੱਕਤ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਅਸੀਂ ਕੋਈ ਵੀ ਕਿਤਾਬ ਬਾਰੇ ਆਨਲਾਈਨ ਹੀ ਪੜ੍ਹ ਸਕਦੇ ਹਾਂ ਜਿਸ ਨਾਲ ਸਾਡੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ